ਪੰਜਾਬ ਵਿੱਚ ਬਹੁਤ ਰਸਮਾਂ ਰੀਤਾਂ ਮਨਾਈਆਂ ਜਾਂਦੀਆਂ ਹਨ ਜਿਸ ਵਿੱਚ ਵਿਆਹ ਸੰਬੰਧੀ ਵੱਖ ਰਸਮਾਂ ਨਿਭਾਈਆਂ ਜਾਂਦੀਆਂ ਹਨ ਮੌਤ ਸੰਬੰਧੀ ਅਤੇ ਜਨਮ ਸੰਬੰਧੀ ਵੱਖ ਵੱਖ ਰਸਮਾਂ ਕੀਤੀਆਂ ਜਾਂਦੀਆਂ ਪਰ ਸਮੇਂ ਦੇ ਬਦਲਾਅ ਨਾਲ ਇਹਨਾਂ ਵਿੱਚ ਬਦਲਾਅ ਆ ਰਿਹਾ ਹੈ ਬਹੁਤ ਸਾਰੀਆਂ ਰੀਤਾਂ ਰਸਮਾਂ ਖਤਮ ਹੋ ਰਹੀਆਂ ਹਨ ਇਸ ਵਿੱਚ ਵਿਆਹ ਜਨ ਵਿਆਹ ਜਨਮ ਅਤੇ ਮੌਤ ਨਾਲ ਸੰਬੰਧਿਤ ਸਾਰੀਆਂ ਰਸਮਾਂ ਘੱਟ ਰਹੀਆਂ ਹਨ ਜੋ ਉਨ੍ਹਾਂ ਦਾ ਮਹੱਤਵ ਘੱਟ ਰਿਹਾ ਹੈ ਜਾਂ ਸਿਰਫ ਨਾ ਮਾਤਰ ਹੀ ਰਸਮਾਂ ਰਹਿ ਗਈਆਂ ਹਨ ਜਿਵੇਂ ਵਿਆਹ ਸੰਬੰਧੀ ਨਾਨਕਿਆਂ ਨੂੰ ਇੱਕ ਮਣ ਮਠਿਆਈ ਦੇਣੀ ਮੌਤ ਸੰਬੰਧੀ ਭੀਧੋੜਾ ਫੇਰਨਾ ਆਦਿ ਰਸਮਾਂ ਘੱਟ ਗਈਆਂ ਹਨ ਸਾਡੇ ਪਰਿਵਾਰ ਵਿੱਚ ਵੀ ਇਹ ਰਸਮਾਂ ਬਹੁਤ ਹੀ ਘੱਟ ਕੀਤੀਆਂ ਜਾਂਦੀਆਂ ਹਨ ਸਮੇਂ ਦੇ ਨਾਲ ਨਾਲ ਸਾਡੇ ਪਰਿਵਾਰ ਵਿੱਚ ਵੀ ਇਹ ਰਸਮਾਂ ਦਾ ਪ੍ਰਚਲਣ ਘੱਟ ਰਿਹਾ ਹੈ ਅਤੇ ਅਸੀਂ ਵੀ ਇਹਨਾਂ ਰਸਮਾਂ ਤੋਂ ਦੂਰ ਹੋ ਰਹੇ ਹਾਂ